ਖੇਤੀਬਾੜੀ ਇੱਕ ਬਹੁਤ ਵਧੀਆ ਚੀਜ਼ ਹੈ ਲੋਕ ਇਹਦੀ ਇਹਦੇ 'ਚ ਉਲਝਣ 'ਚ ਫਸ ਗਏ ਉਹ ਚਾਹੁੰਦੇ ਸਨ ਸਾਰਾ ਕੁਝ ਬੈਠੇ ਬਿਠਾਇਆ ਨੂੰ ਮਿਲ ਜਾਵੇ ਹੱਥਾਂ ਨਾਲ ਕੰਮ ਨਾ ਕਰਨਾ ਪਵੇ ਸੰਦਾਂ ਦੀ ਵਰਤੋਂ ਨਾ ਕਰਨੀ ਪਵੇ ਤਕਨੀਕੀ ਯੁੱਗ ਆ ਜਾਵੇ ਸਾਰਾ ਕੁਝ ਤਕਨੀਕ ਏ ਕਰੀ ਜਾਵੇ ਅਸੀਂ ਹੱਥਾਂ ਪੈਰਾਂ ਨਾਲ ਕੁਛ ਨਾ ਕਰੀਏ ਜੇ ਅਸੀਂ ਖੇਤੀ ਨਹੀਂ ਕਰਾਂਗੇ ਤਾਂ ਅਸੀਂ ਖਾਵਾਂਗੇ ਪੀਵਾਂਗੇ ਕਿੱਥੋਂ ਖੇਤੀਬਾੜੀ ਬਹੁਤ ਵਧੀਆ ਚੀਜ਼ ਹੈ ਖੇਤੀਬਾੜੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਜੇ ਅਸੀਂ ਖੇਤੀ ਕਰਾਂਗੇ ਤਾਂ ਅਸੀਂ ਖਾਵਾਂਗੇ ਅੱਜ ਕੱਲ੍ਹ ਦੀ ਨੌਜਵਾਨ ਪੀੜੀ ਇਹਨੂੰ ਮੰਨਦੀ ਏ ਨਹੀਂ ਹੈਗੀ ਖੇਤੀਬਾੜੀ ਬਹੁਤ ਵਧੀਆ ਚੀਜ਼ ਹੈ